ਮੈਨੂੰ ਬੁਣਾਈ ਕਰਨ ਦੀ ਸਿੱਖਿਆ ਆਪਣੀ ਮੰਮੀ ਤੋਂ ਮਿਲੀ ਕਿਉਂਕਿ ਮੇਰੇ ਮੰਮੀ ਬਹੁਤ ਅੱਛੀ ਬੁਣਾਈ ਕਰਦੇ ਹੁੰਦੇ ਸੀ ਉਹਨਾਂ ਨੇ ਕਾਫੀ ਸਵੈਟਰ ਵਗੈਰਾ ਬਣਾਏ ਜੈਕਟਾਂ ਬਣਾਈਆਂ ਅਤੇ ਉਹ ਮੈਨੂੰ ਦੱਸਦੇ ਰਹੇ ਹੈ ਕਿ ਉਹਨਾਂ ਦੇ ਵੀ ਮੰਮੀ ਜੀ ਬਹੁਤ ਅੱਛੇ ਮਤਲਬ ਕਿ ਬੁਣਾਈ ਕਰਦੇ ਸੀ ਮੇਰੇ ਨਾਨੀ ਜੀ ਦੀ ਵੀ ਹੱਥ ਦੀਆਂ ਕਈ ਬਣੀਆਂ ਹੋਈਆਂ ਚੀਜ਼ਾਂ ਪਈਆਂ ਹੋਈਆਂ ਨੇ ਅਤੇ ਇਹ ਇੱਕ ਪਰਿਵਾਰਕ ਰਵਾਇਤ ਹੀ ਸਮਝ ਲਓ ਅਤੇ ਮੇਰੀਆਂ ਸਹੇਲੀਆਂ ਵੀ ਏ ਏ ਇਹਦੇ ਵਿੱਚ ਸ਼ੌਕ ਰੱਖਦੀਆਂ ਸੀਗੀਆਂ ਇਹ ਉਹਨਾਂ ਤੋਂ ਦੇਖ ਦੇਖ ਕੇ ਮੈਨੂੰ ਵੀ ਸ਼ੌਕ ਜਾਗ ਪਿਆ ਅਤੇ ਮੈਂ ਵੀ ਇਹਦੇ ਵੱਲ ਆਪਣੀ ਰੁਚੀ ਕਰ ਲਈ ਅਤੇ ਇਹਦੇ ਵਿੱਚ ਸਭ ਤੋਂ ਤਾਂ ਪਹਿਲਾਂ ਮੈਂ ਨਾ ਸਲਾਈਆਂ ਸਿੱਖੀਆਂ ਸਲਾਈਆਂ ਹੌਲੀ ਹੌਲੀ ਕਰਦੇ ਕਰਦੇ ਮੈਨੂੰ ਚੀਜ਼ਾਂ ਬਣਾਉਣੀਆਂ ਆ ਗਈਆਂ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਲੱਡੂ ਗੋਪਾਲ ਜੀ ਦੇ ਬਸਤਰ ਬਣਾਏ ਅਤੇ ਉਹਨਾਂ ਦੀ ਕੈਪ ਵਗੈਰਾ ਫਿਰ ਉਹਨਾਂ ਦੀ ਜਿਸ ਤਰ੍ਹਾਂ ਮਤਲਬ ਕੋਟੀ ਵਗੈਰਾ ਜੁਰਾਬਾਂ ਅਤੇ ਇਹਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਕਰੋਸ਼ੀਆ ਕਰੋਸ਼ੀਏ ਦੇ ਨਾਲ ਵੀ ਮੈਂ ਕਾਫੀ ਰੁਮਾਲ ਵਗੈਰਾ ਬਣਾਏ ਅਤੇ ਫਿਰ ਸਰਟਲ ਇਹਦੇ ਵਿੱਚ ਮੈਂ ਲੇਸ ਵਗੈਰਾ ਬਣਾਈਆਂ ਅਤੇ ਇਸ ਤੋਂ ਬਾਅਦ ਯੂਪਿੰਨ ਦਾ ਵੀ ਮੈਂ ਸ਼ੌਕ ਰੱਖਣ ਲੱਗ ਪਈ ਉਹਦੇ ਨਾਲ ਵੀ ਮੈਂ ਕਾਫੀ ਕੁਛ ਬਣਾਇਆ ਅਤੇ ਇਹਦੇ ਵਿੱਚ ਮੈਨੂੰ ਪਰੈਕਸਟ ਇਸ ਵਿੱਚ ਤਾਂ ਲੱਖਾਂ ਟਾਈਮ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਮੈਂ ਪਰਫੈਕਟ ਨਹੀਂ ਹੈਗੀ ਫਿਰ ਮੈਂ ਇਹਦੇ ਵਿੱਚ ਬੁਣਾਈ ਕਰਦੀ ਰਹਿੰਦੀ ਸੀਗੀ ਹੌਲੀ ਹੌਲੀ ਮੈਨੂੰ ਲੱਗਣ ਲੱਗ ਪਿਆ ਕਿ ਨਹੀਂ ਹੁਣ ਮੈਂ ਕਾਫੀ ਅੱਛਾ ਕਰ ਸਕਦੀ ਹਾਂ ਕੰਮ